ਮੈਂ ਪਿਛਲੇ ਮਹੀਨੇ ਅਮਰਨਾਥ ਯਾਤਰਾ ਉੱਤੇ ਗਿਆ ਸੀ ਇਹ ਅਸਥਾਨ ਸਾਡੇ ਦੇਸ਼ ਦੇ ਦੋ ਬਾਡਰਾਂ ਪਰ ਹੈ ਇਸ ਅਸਥਾਨ ਨੂੰ ਜੰਮੂ ਕਸ਼ਮੀਰ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ ਜਿਸ ਕਰਕੇ ਉੱਥੇ ਸੁਰੱਖਿਆ ਦੀ ਮੈਨੂੰ ਬਹੁਤ ਚਿੰਤਾ ਹੋ ਰਹੀ ਸੀ ਕਿਉਂਕਿ ਉੱਥੇ ਕਿਸੇ ਵੀ ਸਮੇਂ ਅਤੰਕਵਾਦੀ ਹਮਲਾ ਹੋ ਜਾਂਦਾ ਹੈ ਉੱਥੇ ਰਸਤੇ ਵਿੱਚ ਕਈ ਥਾਵਾਂ ਉੱਤੇ ਸੁਰੱਖਿਆ ਬਹੁਤ ਸੀ ਅਤੇ ਪਰ ਕਈ ਥਾਵਾਂ ਉੱਤੇ ਸੁਰੱਖਿਆ ਬਿਲਕੁਲ ਨਹੀਂ ਸੀ ਇਸ ਕਰਕੇ ਮੈਨੂੰ ਰਸਤੇ ਵਿੱਚ ਜਾਂਦੇ ਸਮੇਂ ਬਹੁਤ ਚਿੰਤਾਵਾਂ ਸੀ ਦੂਜਾ ਚਿੰਤਾ ਇਹ ਸੀ ਕਿ ਇਹ ਇੱਕ ਪਹਾੜੀ ਇਲਾਕਾ ਸੀ ਜਿੱਥੇ ਕਈ ਕਿਸੇ ਵੀ ਸਮੇਂ ਮੌਸਮ ਖਰਾਬ ਹੋ ਜਾਂਦਾ ਹੈ ਪਰ ਉੱਥੇ ਪਹਾੜਾਂ ਉੱਤੇ ਸੁਰੱਖਿਆ ਘੱਟ ਸੀ ਪਰ ਸਾਈਨ ਬੋਰਡਾਂ ਦੀ ਮਦਦ ਲਈ ਜਾਂਦੀ ਸੀ ਅਤੇ ਕਈ ਥਾਵਾਂ ਉੱਤੇ ਸੁਰੱਖਿਆ ਕਰਮੀ ਸਾਡੀ ਮਦਦ ਲਈ ਹਾਜ਼ਰ ਰਹਿੰਦੇ ਸੀ ਅਤੇ ਸਾਨੂੰ ਅੱਗੇ ਜਾਣ ਦੇ ਰਸਤੇ ਬਾਰੇ ਦੱਸਦੇ ਸੀ ਅਤੇ ਉਹ ਇਹ ਵੀ ਦੱਸਦੇ ਸੀ ਕਿ ਇੱਥੇ ਸਾਨੂੰ ਖਤਰਾ ਨਹੀਂ ਹੈ ਅਤੇ ਉੱਥੇ ਸਾਨੂੰ ਰੁਕਣ ਦਾ ਵੀ ਇੰਤਜ਼ਾਮ ਕਰਦੇ ਸੀ